ਸਾਡੇ ਖੇਤਰ ਵਿੱਚ ਜੇ ਗੱਲ ਕਰੀਏ ਤਾਂ ਪੁਲਿਸ ਦਾ ਪੁਲਿਸ ਪ੍ਰਸ਼ਾਸਨ ਦਾ ਬਹੁਤ ਜ਼ਿਆਦਾ ਕੰਟਰੋਲ ਹਾਂ ਪਰ ਕੁਝ ਘਟਨਾਵਾਂ ਅਹੀਆਂ ਜਿਹੀਆਂ ਹੋ ਜਾਂਦੀਆਂ ਹਨ ਕਿ ਜਿਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਜਿਵੇਂ ਕਿ ਕੁਝ ਠੱਗੀਆਂ ਚੋਰੀਆਂ ਹੋ ਜਾਂਦੀਆ ਨੇ ਐਕਸੀਡੈਂਟ ਹੋ ਜਾਂਦੇ ਨੇ ਜਿਹਨਾਂ ਜਿਹੜੀ ਕਿ ਜਿਹੜੀਆਂ ਕਿ ਰੋਕੀਆਂ ਨਹੀਂ ਜਾ ਸਕਦੀਆਂ ਤਾਂ ਉਹਨਾਂ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਆਪਣੀਆਂ ਪਾਵਰਾਂ ਦਾ ਆਪਣੇ ਅਹੁਦਿਆਂ ਦਾ ਇਸਤੇਮਾਲ ਕਰਕੇ ਮੌਕਿਆਂ 'ਤੇ ਪੁੱਜ ਕੇ ਜਿਹੜੇ ਵੀ ਚੋਰ ਠੱਗ ਹੁੰਦੇ ਨੇ ਉਹਨਾਂ ਨੂੰ ਫੜਦੀਆਂ ਨੇ ਉਹਨਾਂ ਦੇ ਉੱਤੇ ਐੱਫ ਆਈ ਆਰਾਂ ਕਰਦੀਆਂ ਨੇ ਅਤੇ ਉਹਨਾਂ ਨੂੰ ਜਿਹੜੇ ਕੋਰਟ ਦੇ ਵਿੱਚ ਪੇਸ਼ ਕਰਦੀਆਂ ਨੇ ਜੋ ਕਿ ਉਹਨਾਂ ਦੇ ਖਿਲਾਫ਼ ਬਣਦੀਆਂ ਕਾਰਵਾਈਆਂ ਕੀਤੀਆਂ ਜਾਣ ਜੇ ਕੋਈ ਵੀ ਐਕਸੀਡੈਂਟਲ ਕੋਈ ਵੀ ਕੇਸ ਹੁੰਦੇ ਨੇ ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੀਆਂ ਵੀ ਮੌਕੇ ਦੇ ਉੱਤੇ ਜਲਦੀ ਪੁੱਜ ਕੇ ਕਾਰਵਾਈਆਂ ਕੀਤੀਆਂ ਜਾਂਦੀਆਂ ਹਨ ਆਹ ਰਾਸਤਿਆਂ ਦੇ ਉੱਤੇ ਜਿਹੜੇ ਐਕਸੀਡੈਂਟ ਹੁੰਦੇ ਨੇ ਇਹਨਾਂ ਦੇ ਲਈ ਤਾਂ ਇੱਕ ਪੈਟਰੋਲਿੰਗ ਕਾਰਾਂ ਵੀ ਨੇ ਜਿਹਨਾਂ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਪੂਰੇ ਖੇਤਰ ਦਾ ਦੌਰਾ ਕਰਦੇ ਰਹਿੰਦੇ ਨੇ ਅਤੇ ਉੱਥੇ ਜੇ ਕੋਈ ਵੀ ਵਾਰਦਾਤ ਹੁੰਦੀ ਹੈ ਉਸ ਵਾਰਦਾਤ ਨੂੰ ਪਹਿਲਾਂ ਹੀ ਰੋਕਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਭਰਭੂਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਕੋਈ ਵੀ ਵਾਰਦਾਤ ਨਾ ਹੋਵੇ ਅਤੇ ਉਸ ਜਿਹੜਾ ਖੇਤਰ ਆ ਉੱਥੇ ਸੁੱਖ ਸ਼ਾਂਤੀ ਬਣੀ ਰਹੇ ਅਤੇ ਲੋਕਾਂ ਲੋਕਾਂ ਨੂੰ ਵੀ ਸਚਰਕ ਸਤਰਕ ਕੀਤਾ ਜਾਂਦਾ ਹੈ ਕਿ ਵੀ ਕਿਸੇ ਵੀ ਪ੍ਰਕਾਰ ਦੀ ਜੇ ਕੋਈ ਕੋਈ ਵੀ ਅਪਰਾਧ ਹੋਣ ਵਾਲਾ ਹੈ ਕਿ ਕਿਸੇ ਨੂੰ ਉਸ ਅਪਰਾਧ ਦੇ ਬਾਰੇ ਪਤਾ ਹੋਵੇ ਪਹਿਲਾਂ ਪਤਾ ਲੱਗ ਜਾਵੇ ਕਿ ਏਵੇ ਦਾ ਕੋਈ ਅਪਰਾਧ ਹੋਣ ਵਾਲਾ ਹੈ ਅਤੇ ਇਹਨਾਂ ਨੇ ਹੈਲਪਲਾਈਨ ਨੰਬਰ ਵੀ ਕਾਫੀ ਬਣਾਏ ਵੇ ਨੇ ਜਿਹੜੇ ਕਿ ਉਸ ਹੈਲਪਲਾਈਨ ਨੰਬਰ ਦੇ ਉੱਤੇ ਖੋਲ੍ਹ ਕਰਨ ਦੇ ਨਾਲ ਤੁਰੰਤ ਹੀ ਪੁਲਿਸ ਉੱਥੇ ਆ ਜਾਂਦੀ ਹੈ ਅਤੇ ਐਕਸ਼ਨ ਲੈ ਲੈਂਦੀ ਹੈ ਅਤੇ ਮੈਂ ਇਹ ਗੱਲ ਕਹਿਣਾ ਚਾਉਂਦਾ ਹੈ ਕਿ ਜਿਹੜੀ ਪੁਲਿਸ ਕ ਪੁਲਿਸ ਵੀ ਅੱਜ ਕੱਲ੍ਹ ਕਈ ਵਾਰੀ ਕੀ ਹੁੰਦਾ ਹੈ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਕੁਝ ਆਪਣੀਆਂ ਪਾਵਰਾਂ ਦਾ ਮਿਸਯੂਜ਼ ਕਰਦੀ ਹਾਂ ਮਿਸਯੂਸ ਕਰਨ ਦੇ ਦੌਰਾਨ ਕੁਝ ਜਿਹੜੇ ਲੋਕ ਮਾਸੂਮ ਲੋਕ ਨੇ ਅਨਪ ਜਿਹੜੇ ਅਪਰਾਧ ਜਿਹਨਾਂ ਨੇ ਕੀਤਾ ਵੀ ਨਹੀਂ ਉਹਨਾਂ ਨਾਲ ਵੀ ਕਈ ਵਾਰੀ ਧੱਕਾ ਹੋ ਜਾਂਦਾ ਹੈ ਤਾਂ ਮੈਂ ਇਸ ਚੀਜ਼ ਦੀ ਗੱਲ ਕਰਦੇ ਹਾਂ ਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਥੋੜ੍ਹੀ ਜਿਹੀ ਜਿਹੜੀ ਕਿ ਲੋਕ ਬ ਬੇ ਨਿਰਦੋਸ਼ ਨੇ ਉਹਨਾਂ ਦੇ ਉੱਤੇ ਜਿਹੜੇ ਵੀ ਕਾਰਵਾਈ ਨਾਜਾਇਜ਼ ਕਾਰਵਾਈ ਕੀਤੀ ਜਾਂਦੀ ਹੈ ਉਹਨਾਂ ਦੇ ਉੱਤੇ ਲਗਾਮ ਪੁਲਿਸੀਆਂ ਦੇ ਉੱਤੇ ਵੀ ਲਗਾਮ ਲਗਾਈ ਜਾਵੇ ਕਿ ਉਹ ਨਿਰਦੋਸ਼ ਲੋਕਾਂ ਨੂੰ ਦੇ ਖਿਲਾਫ਼ ਕੋਈ ਝੁੱਠੀ ਕਾਰਵਾਈ ਨਾ ਕਰਨ